ਪੰਜਾਬੀ ਭਾਸ਼ਾ ਦੀਆਂ ਸਾਨੂੰ ਬਹੁਤ ਸਾਰੀਆਂ ਵਿਲੱਖਣ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਇੱਥੇ ਮੈਂ ਤੁਹਾਨੂੰ ਗੁਣਾਂ ਬਾਰੇ ਦੱਸਾਂਗੀ ਪਹਿਲਾਂ ਇਹ ਕਿ ਪੰਜਾਬੀ ਇੱਕ ਸੁਰਤਾਤਮਿਕ ਭਾਸ਼ਾ ਹੈ ਸਾਡੇ ਪਾਸੇ ਦਾ ਸ਼ਬਦ ਹੈ ਚਾਅ ਜਿਸ ਨੂੰ ਅਸੀਂ ਦੋ ਤਰੀਕਿਆਂ ਨਾਲ਼ ਦੇਖਦੇ ਹਾਂ ਪਹਿਲਾਂ ਚਾਅ ਜਿਸਨੂੰ ਅਸੀਂ ਚਾਅ ਕਹਿ ਦਿੰਦੇ ਹਾਂ ਜਾਂ ਕਿਸੇ ਚੀਜ਼ ਦਾ ਸਾਨੂੰ ਚਾਅ ਚੜ੍ਹ ਜਾਂਦਾ ਹੈ ਅਤੇ ਦੂਜਾ ਚਾਹ ਚਾਹ ਦੀ ਪੱਤੀ ਵਾਲਾ ਚਾਹ ਅਸੀਂ ਦੇਖਦੇ ਹਾਂ ਕਿ ਚਾਹ ਦੀ ਪੱਤੀ ਦੇ ਵਿੱਚ ਅਸੀਂ ਜੋ ਹਾਹਾ ਬੋਲਦੇ ਹਾਂ ਉਸ ਨੂੰ ਪੂਰਾ ਨਹੀਂ ਬੋਲਦੇ ਹਾਂ ਸਿਰਫ਼ ਸੁਰ ਜਾਂ ਟੋਨ ਹੀ ਬੋਲਦੇ ਹਾਂ ਇਸ ਦੇ ਲਈ ਚੱਚਾ ਅਤੇ ਚਾਹ ਵਿੱਚ ਜੋ ਫ਼ਰਕ ਹੈ ਉਹ ਸੁਰ ਅਤੇ ਟੋਨ ਦਾ ਹੀ ਹੈ ਇਸ ਲਈ ਸੁਰ ਅਤੇ ਟੋਨ ਪੰਜਾਬੀ ਦੇ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੈ ਅਤੇ ਇਸ ਦੇ ਨਾਲ਼ ਪੰਜਾਬੀ ਵੀ ਪੰਜਾਬੀ ਭਾਸ਼ਾ ਵਿੱਚ ਦੁੱਤੀਕਰਨ ਦੀ ਭਰਮਾਰ ਹੈ ਅਸੀਂ ਲਿਖਤ ਵਿੱਚ ਅੱਧਕ ਪਾ ਕੇ ਦੁੱਤ ਧੁਨੀਆਂ ਦਾ ਉਚਾਰਨ ਕਰਦੇ ਹਾਂ ਜਿਵੇਂ ਦੁੱਧ ਪੁੱਤ ਨੱਕ ਪੱਤਾ ਮੱਥਾ ਅੱਖ ਨੱਕ ਆਦਿ ਅਤੇ ਹਿੰਦੀ ਵਿੱਚ ਜੇ ਇਹਨਾਂ ਦਾ ਉਚਾਰਨ ਦੇਖੀਏ ਤਾਂ ਇਹ ਦੂਧ ਪੂਤ ਮਾਥਾ ਵਸਤੂ ਨੱਕ ਨਾਕ ਆਦਿ ਹੋ ਜਾਂਦੇ ਨੇ ਅਤੇ ਪੰਜਾਬੀ ਆਮ ਤੌਰ 'ਤੇ ਵੀ ਜਗਾਤਮਿਕ ਭਾਸ਼ਾ ਹੈ ਪੰਜਾਬੀ ਪਿਛੇਤਰ ਆਤਮਿਕ ਭਾਸ਼ਾ ਵੀ ਹੈ ਉਂਝ ਪੰਜਾਬੀ ਵਿੱਚ ਅਗੇਤਰ ਵੀ ਹਨ ਪਰ ਪਿਛੇਤਰ ਜ਼ਿਆਦਾ ਗਿਣਤੀ ਦੇ ਵਿੱਚ ਹੋਣ ਕਰਕੇ ਇਸਨੂੰ ਪਿਛੇਤਰ ਆਤਮਿਕ ਭਾਸ਼ਾ ਵੀ ਕਿਹਾ ਜਾਂਦਾ ਹੈ